ਸਤਿ ਸ਼੍ਰੀ ਅਕਾਲ ਜੀ ਫਲਿੱਪਕਾਰਟ ਤੋਂ ਬੋਲਦੇ ਹੋ ਜੀ ਮੈਂ ਤੁਹਾਡੇ ਐਪ ਰਾਹੀਂ ਇੱਕ ਟੀ ਸ਼ਰਟ ਔਰਡਰ ਕੀਤੀ ਸੀ ਜਦੋਂ ਉਹ ਮੇਰੇ ਕੋਲ ਪਹੁੰਚੀ ਤਾਂ ਉਹਦੀ ਪੈਕਿੰਗ ਬਹੁਤ ਵਧੀਆ ਕੀਤੀ ਹੋਈ ਸੀ ਜਦੋਂ ਮੈਂ ਉਸਨੂੰ ਖੋਲ੍ਹਿਆ ਤਾਂ ਉਹਦਾ ਕਲਰ ਮੈਨੂੰ ਟੀ ਸ਼ਰਟ ਦਾ ਬਹੁਤ ਸੋਹਣਾ ਲੱਗਿਆ ਜਦੋਂ ਮੈਂ ਉਹਨੂੰ ਪਾਇਆ ਤਾਂ ਉਹਦਾ ਬਹੁਤ ਸੋਹਣੀ ਫਿਟਿੰਗ ਸੀ ਜਿਸ ਨੂੰ ਕਿ ਮੇਰੇ ਸਾਰੇ ਘਰਦਿਆਂ ਨੇ ਬਹੁਤ ਪਸੰਦ ਕੀਤਾ ਕਹਿੰਦੇ ਬਹੁਤ ਸੋਹਣੀ ਟੀ ਸ਼ਰਟ ਆ ਅਤੇ ਉਹਦਾ ਰੇਟ ਵੀ ਬਹੁਤ ਵਾਜਬ ਸੀ ਦੂਸਰੇ ਔਨਲਾਈਨ ਬਜ਼ਾਰ ਨਾਲੋਂ ਬਹੁਤ ਸਸਤਾ ਤਾ ਇਸ ਲਈ ਮੈਂ ਤੁਹਾਡੀ ਐਪ ਦਾ ਧੰਨਵਾਦ ਕਰਦਾ ਹਾਂ ਤੁਹਾਡੀ ਮੈਨੂੰ ਸਰਵਿਸ ਬਹੁਤ ਵਧੀਆ ਲੱਗੀ ਸਤਿ ਸ਼੍ਰੀ ਅਕਾਲ